ਹੈਲੋ ਹਾਂਜੀ ਸਿੰਘ ਜੀ ਕਿਵੇਂ ਹੋ ਜੀ ਹਾਂਜੀ ਹਾਂਜੀ ਹੁਣ ਫਰੀ ਹੋ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਪਹਿਲਾਂ ਏਅਰ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਇਹ ਆਪਾਂ ਨਾ ਮੈਂ ਹਾਂਜੀ ਅਤੇ ਮੈਂ ਨਾ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਜਿਹੜਾ ਆਪਾਂ ਪਲਾਟ ਲਿੱਤਾ ਸੀ ਆਪਣਾ ਸਾਂਝਾ ਜੀ ਹਾਂਜੀ ਸਾਹਮਣੇ ਜਿਹੜਾ ਆਪਣੇ ਘਰ ਦੇ ਪਿਆ ਜੀ ਹਾਂਜੀ ਹਾਂਜੀ ਇਹਨਾਂ ਜੀ ਉਹ ਉਹਨਾਂ ਦੇ ਨਾਲ ਕੱਲ੍ਹ ਪਰਸੋਂ ਦਾ ਦੇਖ ਰਿਹਾ ਜੀ ਮੈਂ ਉਹ 'ਚ ਅਵਾਰਾ ਪਸ਼ੂ ਵਗੈਰਾ ਲੋਕ ਕੂੜਾ ਸਿੱਟ ਰਹੇ ਆ ਅਤੇ ਉਹ ਹੋਰ ਅਤੇ ਉਹ ਨਾ ਦੇਖ ਕੇ ਜਦੋਂ ਪੈਸਾ ਲੱਗਿਆ ਅਤੇ ਆਪਣੀ ਚੀਜ਼ ਆ ਵੇਖ ਕੇ ਮਨ ਦੁਖੀ ਹੁੰਦਾ ਅਤੇ ਵੀ ਆਪਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਜੀ ਇਹਦਾ ਜੀ ਮੈਂ ਤੁਹਾਡੇ ਤੋਂ ਇਹ ਸਲਾਹ ਲੈਣਾ ਚਾਹੁੰਦਾ ਵੀ ਉਹਦਾ ਕੀਤਾ ਕੀ ਜਾਵੇ ਜੀ ਹੁਣ ਇੰਨੀ ਗੰਦਗੀ ਪੈ ਰਹੀ ਆ ਪਸ਼ੂ ਵੀ ਆ ਰਹੇ ਆ ਕੋਈ ਐਵੇਂ ਨਾ ਕੋਈ ਕੇਅਰ ਹੈ ਨਹੀਂ ਉਹਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਕਰ ਲੈਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਦਾਂ ਕਰਦੇ ਜੀ ਆਪਾਂ ਨਾ ਚਾ ਚਾਰ ਦਵਾਰੀ ਕਰ ਦਿੰਦੇ ਕੰਧ ਦੀ ਅਤੇ ਨਾਲ ਗੇਟ ਲਾ ਦਿੰਦੇ ਇੱਥੇ ਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਇਹ ਤਾਂ ਤੁਸੀਂ ਸਲਾਹ ਬਹੁਤ ਵਧੀਆ ਦਿੱਤੀ ਮੈਨੂੰ ਜੀ ਸਹੀ ਆ ਬਿਲਕੁਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਇਸ ਕਰਕੇ ਇਸ ਕਰਕੇ ਮੈਂ ਤੁਹਾਡੇ ਤੋਂ ਸਲਾਹ ਲਿਤੀ ਹੈ ਤੁਸ ਥੋਤੁਹਾਨੂੰ ਤੁਸੀਂ ਜਾਣਕਾਰ ਆ ਤੁਸੀਂ ਸਾਰੇ ਕੰਮਾਂ 'ਚੋਂ ਨਿਕਲੇ ਹੋਏ ਆ ਹਾਂਜੀ ਹਾਂਜੀ

ਹਾਂਜੀ ਇੱਕ ਤਾਂ ਉਹ ਪੁੱਛ ਲਓ ਜੀ ਅਤੇ ਇੱਕ ਮੇਰੀ ਐਂ ਸਲਾਹ ਸੀ ਆਪਾਂ ਮਨ ਕੇ ਚੱਲੋ ਅਤੇ ਆਪਾਂ ਵੈਸੇ ਵੀ ਹੁਣ ਤੁਹਾਨੂੰ ਪਤਾ ਕੰਮਕਾਰ ਵਾਲੇ ਹਾਂ ਹੈਗੇ ਜੀ ਤਾਂ ਆਪਾਂ ਥਕਾਨ ਹੋ ਜਾਂਦੀ ਆਪਾਂ ਨੂੰ ਜੀ ਅਤੇ ਆਪਾਂ ਜੇ ਇੱਥੇ ਮਨ ਕੇ ਚੱਲੋ ਇੱਕ ਨੈਟ ਲਾ ਦੇਈਏ ਜੀ ਸ਼ਾਮ ਨੂੰ ਵਾਲੀਬਾਲ ਖੇਡ ਲਿਆ ਕਰਕੇ ਜੀ ਹਾਂਜੀ ਹਾਂਜੀ ਉਹ ਵੀ ਥੋੜ੍ਹਾ ਸਰੀਰ ਚਲੋ ਠ ਠੀਕ ਹੈ ਸਰ ਫਿਰ ਆਪਾਂ ਮਿਲ ਕੇ ਗੱਲ ਕਰਦੇ ਹਾਂ ਜੀ ਹਾਂ ਮਿਲ ਕੇ ਗੱਲ ਕਰਦੇ ਠੀਕ ਹੈ ਜੀ ਠੀਕ ਓਕੇ ਓਕੇ